ਜੇਕਰ ਅਸੀਂ ਯਾਤਰੀ ਬੱਸਾਂ ਦੀ ਗੱਲ ਕਰਦੇ ਹਾਂ ਤਾਂ ਉਹ ਬਹੁਤ ਪ੍ਰਕਾਰ ਦੀਆਂ ਉਹ ਤੁਹਾਡੇ 'ਤੇ ਨਿਰਭਰ ਕਰਦਾ ਕਿ ਤੁਸੀਂ ਕਿੰਨਾ ਲੰਬਾ ਸਫ਼ਰ ਕਰ ਰਹੇ ਹੋ ਅਤੇ ਕਿਸ ਤਰ੍ਹਾਂ ਦਾ ਕਰਨਾ ਚਾਹੁੰਦੇ ਹੋ ਹੁਣ ਜਿਵੇਂ ਅਸੀਂ ਸਫ਼ਰ ਕਰਦੇ ਹਾਂ ਆਪਣੀ ਫੈਮਲੀ ਦੇ ਨਾਲ ਅਤੇ ਅੱਜ ਕੱਲ੍ਹ ਟਰੈਵਲਰ ਚੱਲੇ ਹੋਏ ਨੇ ਜਿਹਦੇ ਵਿੱਚ ਵੱਧ ਸਹੂਲਤ ਹੁੰਦੀ ਹੈ ਸੀਟਾਂ ਗਿਣੀਆਂ ਚੁਣਵੀਆਂ ਹੁੰਦੀਆਂ ਉਹਦੇ ਵਿੱਚ ਸਿਰਫ਼ ਆਪਣੀ ਫੈਮਿਲੀ ਹੀ ਬੈਠ ਸਕਦੀ ਹੈ ਉਹ ਜ਼ਿਆਦਾ ਕੰਫਰਟੇਬਲ ਹੋ ਜਾਂਦਾ ਪਰ ਜੇਕਰ ਤੁਸੀਂ ਦੋ ਜਣਿਆਂ ਨੇ ਜਾਂ ਤਿੰਨ ਜਣਿਆਂ ਨੇ ਜਾਣਾ ਫਿਰ ਤੁਸੀਂ ਪ੍ਰੈਫਰ ਵੀ ਕਰ ਸਕਦੇ ਹੋ ਸਰਕਾਰੀ ਬੱਸਾਂ ਚੱਲਦੀਆਂ ਅੱਜ ਕੱਲ੍ਹ ਅੱਜ ਕੱਲ੍ਹ ਪ੍ਰਾਈਵੇਟ ਬੱਸਾਂ ਬਹੁਤ ਚੱਲ ਪਈਆਂ ਹਾਂ ਉਹ ਤੁਹਾਡੇ 'ਤੇ ਨਿਰਭਰ ਕਰਦੇ ਆ ਕਿ ਤੁਸੀਂ ਕਿਹੋ ਜਿਹੀ ਫੈਸਿਲਿਟੀ ਲੈਣੀ ਹੈ ਕਿਉਂਕਿ ਸ ਪ੍ਰਾਈਵੇਟ ਬੱਸਾਂ ਵੀ ਦੋ ਤਰੀਕੇ ਦੀਆਂ ਤਿੰਨ ਤਰੀਕੇ ਦੀਆਂ ਚੱਲਦੀਆਂ ਕਿਉਂਕਿ ਕਈ ਡਬਲ ਡੇਕਰ ਏ ਸੀ ਜਾਂ ਫਿਰ ਆਪਾਂ ਕਹਿ ਦੇਈਏ ਵਿਦਾਊਟ ਏ ਸੀ ਪਰ ਉਹਦੇ 'ਚ ਪ੍ਰਾਈਜ ਦਾ ਜਿਹੜੇ ਟਿਕਟ ਦਾ ਪ੍ਰਾਈਜ ਆ ਉਹ ਵੀ ਵੱਖ ਵੱਖ ਹੁੰਦਾ ਹੁਣ ਉਹ ਤੁਹਾਡੇ 'ਤੇ ਨਿਰਭਰ ਕਰਦਾ ਕਿ ਤੁਸੀਂ ਕਿੰਨੀ ਟਿਕਟ ਲੈਂਦੇ ਹੋ ਜਾਂ ਕਿੰਨਾ ਪ੍ਰਾਈਜ ਦਿੰਦੇ ਹੋ ਤੁਸੀਂ ਕਿਹੋ ਜਿਹੀ ਫੈਸਿਲਿਟੀ ਲੈਣਾ ਚਾਹੁੰਦੇ ਹੋ ਬਾਕੀ ਫ਼ਰਕ ਇਹ ਹੀ ਹੈ ਕਿ ਜੋ ਪ੍ਰਾਈਵੇਟ ਹੁੰਦੀ ਹੈ ਵਿਦਾਊਟ ਏ ਸੀ ਜਾਂ ਜਿਹਨਾਂ ਨੂੰ ਆਪਾਂ ਸਰਕਾਰੀ ਕਹਿ ਦੇਈਏ ਉਹਨਾਂ ਵਿੱਚ ਬੈਠਣ ਦੀ ਜਗ੍ਹਾ ਬਹੁਤ ਘੱਟ ਹੁੰਦੀ ਹੈ ਉਹਨਾਂ ਵਿੱਚ ਭੀੜ ਭੜੱਕਾ ਬਹੁਤ ਜ਼ਿਆਦਾ ਹੁੰਦਾ ਪਰ ਜੋ ਅਸੀਂ ਜ਼ਿਆਦਾ ਟਿਕਟ ਦੇ ਕੇ ਏ ਸੀ ਬੱਸਾਂ 'ਚ ਜਾਂਦੇ ਹਾਂ ਜਾਂ ਅਸੀਂ ਡਬਲ ਡੈਕਲ 'ਚ ਜਾਂਦੇ ਹਾਂ ਉਹਦੇ 'ਚ ਸੀਮਿਤ ਸੀਟਾਂ ਹੁੰਦੀਆ ਉਹਦੇ 'ਚ ਪਹਿਲਾਂ ਹੀ ਬੁਕਿੰਗ ਹੋ ਜਾਂਦੀ ਹੈ ਇਸ ਕਰਕੇ ਇਸ ਚੀਜ਼ ਨੂੰ ਅੱਜ ਕੱਲ੍ਹ ਜ਼ਿਆਦਾ ਵਧਾਇਆ ਜਾ ਰਿਹਾ ਹੈ ਹੁਣ ਕਈ ਸ਼ਹਿਰਾਂ ਵਿੱਚ ਹਾਈਡਰੋਜਨ ਨਾਲ ਚੱਲਣ ਵਾਲੀਆਂ ਬੱਸਾਂ ਵੀ ਆ ਗਈਆਂ ਹਨ ਜਿਹੜੀ ਕਿ ਪ੍ਰਦੂਕ ਪ੍ਰਦੂਸ਼ਣ ਨੂੰ ਵੀ ਹਾਨੀ ਨਹੀਂ ਪਹੁੰਚਾਉਂਦੀਆਂ ਇਸ ਕਰਕੇ ਸਾਨੂੰ ਉਹਨਾਂ ਨੂੰ ਵੀ ਪ੍ਰੈਫਰੈਂਸ ਦੇਣੀ ਚਾਹੀਦੀ ਹੈ ਪੰਜਾਬ 'ਚ ਅੱਜ ਕੱਲ੍ਹ ਤਾਂ ਸਰਕਾਰੀ ਬੱਸਾਂ ਵਿੱਚ ਇਸਤਰੀਆਂ ਨੂੰ ਵੀ ਫਰੀ ਬਿਠਾਇਆ ਜਾਂਦਾ ਹੈ ਜੋ ਸਰਕਾਰ ਨੇ ਪੋਲਿਸੀ ਬਣਾਈ ਹੈ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਯਾਤਰਾਵਾਂ ਆਪਣੇ 'ਤੇ ਨਿਰਭਰ ਕਰਦੀਆਂ ਕਿ ਆਪਾਂ ਕਿਸ ਤਰੀਕੇ ਦੀਆਂ ਕਰਨੀਆਂ ਜਾਂ ਆਪਾਂ ਸਰਕਾਰੀ 'ਚ ਕਰਨੀਆਂ ਵਧੀਆ 'ਚ ਕਰਨੀਆਂ ਪ੍ਰਾਈਵੇਟ 'ਚ ਕਰਨੀਆਂ ਅਸੀਂ ਕਿਹੋ ਜਿਹੀ ਫੈਸਿਲਿਟੀ ਲੈਣੀ ਹੈ